ਮੌਸਮ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਮੌਸਮ ਦੀਆਂ ਤਬਦੀਲੀਆਂ ਦੇ ਨਾਲ ਫ਼ਸਲਾਂ ਬਹੁਤ ਹੀ ਪ੍ਰਭਾਵਿਤ ਹੁੰਦੀਆਂ ਨੇ ਜਿਵੇਂ ਕਿ ਦੇਖਿਆ ਜਾਵੇ ਅੱਜ ਦੇ ਟਾਈਮ 'ਚ ਜੋ ਹੁਣ ਹਾਲ ਦੀ ਦੇ ਟਾਈਮ ਦੇ ਵਿੱਚ ਦੇਖਿਆ ਜਾਵੇ ਤਾਂ ਸਾਉਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਮੌਨਸੂਨ ਬਹੁਤ ਹੀ ਜ਼ੋਰ ਸ਼ੋਰ ਨਾਲ ਅੱਗੇ ਵੱਧ ਰਿਹਾ ਹੈ ਲਗਾਤਾਰ ਦੋ ਤਿੰਨ ਦਿਨ ਬਾਰਸ਼ ਹੋਣ ਦੇ ਬਾਵਜੂਦ ਫ਼ਸਲਾਂ ਕਾਫੀ ਪ੍ਰਭਾਵਿਤ ਹੋਈਆਂ ਨੇ ਜ਼ਿਆਦਾ ਪਾਣੀ ਹੋਣ ਦੇ ਬਾਵਜੂਦ ਫ਼ਸਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ ਜਿਹੜੀ ਆਮ ਬਾਰਸ਼ ਪੈਂਦੀ ਹੈ ਉਸ ਨਾਲ ਫ਼ਸਲਾਂ ਨੂੰ ਫਾਇਦਾ ਹੁੰਦਾ ਹੈ ਪਰ ਜਦੋਂ ਲਗਾਤਾਰ ਬਾਰਸ਼ ਪਈ ਜਾਵੇ ਅਤੇ ਬਾਰਸ਼ ਰੁਕੇ ਨਾ ਉੱਤੋਂ ਪਾਣੀ ਦਾ ਕੋਈ ਨਿਕਾਸੀ ਪ੍ਰਬੰਧ ਨਾ ਹੋਵੇ ਤਾਂ ਮੌਸਮ ਦਾ ਕ ਫ਼ਸਲਾਂ ਦੇ ਉੱਤੇ ਕਾਫੀ ਮਾੜਾ ਪ੍ਰਭਾਵ ਪੈ ਸਕਦਾ ਹੈ ਅਤੇ ਪੈਂਦਾ ਹੈ ਅਤੇ ਕੀੜੇ ਮਕੌੜਿਆਂ ਦਾ ਦੇਖਿਆ ਜਾਵੇ ਕਿ ਕੁਝ ਮਿੱਤਰ ਕੀੜੇ ਵੀ ਹਨ ਜੋ ਫ਼ਸਲਾਂ ਨੂੰ ਲਾਭਦਾਇਕ ਹੁੰਦੇ ਹਨ ਪਰ ਜ਼ਿਆਦਾਤਰ ਅੱਜ ਦੇ ਟਾਈਮ ਦੇ ਵਿੱਚ ਜਾਅਲੀ ਰੇਹਾਂ ਸਪ੍ਰੇਹਾਂ ਦਾ ਨਕਲੀ ਰੇਹਾਂ ਸਪ੍ਰੇਹਾਂ ਪਾ ਕੇ ਅਸੀਂ ਆਪਣੇ ਮਿੱਤਰ ਕੀੜੇ ਖ਼ਤਮ ਕਰ ਲਏ ਅਤੇ ਦੁਸ਼ਮਣ ਕੀੜੇ ਦੀ ਜਨਸੰਖਿਆ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੁਣ ਦੇ ਟਾਈਮ ਦੇ ਵਿੱਚ ਵੱਧ ਰਹੀ ਹੈ ਜਿਸ ਕਾਰਨ ਫ਼ਸਲਾਂ ਬਹੁਤ ਪ੍ਰਭਾਵਿਤ ਹੁੰਦੀਆਂ ਨੇ ਫ਼ਸਲਾਂ ਦਾ ਨੁਕਸਾਨ ਵੱਧਦਾ ਜਾ ਰਿਹਾ ਹੈ